ਪੁਰਾਣੇ ਗੀਤਾਂ ਅਤੇ ਅੱਜ ਦੇ ਗੀਤਾਂ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਕਿਉਂਕਿ ਪੁਰਾਣੇ ਗੀਤ ਆਪਣੀ ਜਗ੍ਹਾ 'ਤੇ ਬਹੁਤ ਅੱਛੇ ਹਨ ਕਿਉਂਕਿ ਉਹਨਾਂ ਦੇ ਨਾ ਕਈ ਕਈ ਟਿਊਨਸ ਬਹੁਤ ਅੱਛੀਆਂ ਨੇ ਬਹੁਤ ਲੰਬੇ ਲੰਬੇ ਗਾਣੇ ਨੇ ਜਿਹਨਾਂ 'ਤੇ ਡਾਂਸ ਵੀ ਬਹੁਤ ਵਧੀਆ ਹੁੰਦਾ ਨੱਚਣ ਨੂੰ ਦਿਲ ਕਰਦਾ ਬੰਦਾ ਆਪ ਹੀ ਨੱਚ ਲੈਂਦਾ ਆ ਹੈ ਨਾ ਗਾਣਾ ਸੁਣਦੇ ਸਾਰ ਹੀ ਅੱਜ ਦੇ ਗੀਤਾਂ ਦੇ ਵਿੱਚ ਵੀ ਬਹੁਤ ਵਧੀਆ ਟਿਊਨਸ ਨੇ ਬਹੁਤ ਵਧੀਆ ਅੱਛੇ ਬੋਲ ਨੇ ਕਈ ਗੀਤਾਂ ਦੇ ਤਾਂ ਤਾਂ ਕਰਕੇ ਹਾਂ ਮਤਲਬ ਹਰ ਬੰਦੇ ਦਾ ਨੱਚਣ ਨੂੰ ਦਿਲ ਕਰਦਾ ਕਿ ਕਈ ਗੀਤ ਆਪਾਂ ਸਭ ਨਾਲ ਬੈਠ ਕੇ ਵੀ ਸੁਣ ਸਕਦੇ ਹਾਂ ਇੱਦਾਂ ਦੇ ਗੀਤ ਨੇ ਅੱਜ ਦੇ ਵੀ ਪਹਿਲਾਂ ਦੇ ਵੀ ਬਹੁਤ ਅੱਛੇ ਅੱਛੇ ਗਾਣੇ ਨੇ ਮੈਨੂੰ ਪੁਰਾਣੇ ਜ ਪੁਰਾਣੇ ਗੀਤ ਦੇ ਅੱਜ ਦੇ ਗੀਤ ਦੋਨੋਂ ਹੀ ਅੱਛੇ ਲੱਗਦੇ ਨੇ ਕਿਉਂਕਿ ਉਹ ਵੀ ਕਿਸੇ ਹੱਦ ਤੱਕ ਬਹੁਤ ਅੱਛੇ ਨੇ ਉਹ ਵੀ ਦੂਜੇ ਵੀ ਪੁਰਾਣੇ ਵੀ ਬਹੁਤ ਵਧੀਆ ਨੇ ਇਸ ਕਰਕੇ ਮੈਂ ਦੋਨਾਂ 'ਚੋਂ ਕੋਈ ਵੀ ਇੱਦਾਂ ਨਹੀਂ ਕਹੂੰਗੀ ਕਿ ਬਹੁਤ ਜ਼ਿਆਦਾ ਮੈਨੂੰ ਇਹ ਪਸੰਦ ਨੇ ਜਾਂ ਬਹੁਤ ਜ਼ਿਆਦਾ ਇਹ ਪਸੰਦ ਨੇ ਕਿਉਂਕਿ ਦੋਨੋਂ ਹੀ ਬਹੁਤ ਅੱਛੇ ਨੇ ਆਪਣੀ ਆਪਣੀ ਜਗ੍ਹਾ 'ਤੇ ਕੁਛ ਨਵੇਂ ਨਵੇਂ ਸਿੰਗਰਾਂ ਵਿੱਚੋਂ ਬਹੁਤ ਵਧੀਆ ਵਧੀਆ ਸਿੰਗਰ ਵੀ ਨੇ ਜਿਹੜੇ ਕਿ ਜਿਹਨਾਂ ਦੇ ਗਾਣੇ ਜਿਹਨਾਂ ਦੇ ਬੋਲ ਬੋਲ ਹੀ ਬਹੁਤ ਅੱਛੇ ਨੇ ਜਿਹਨਾਂ ਦੀਆਂ ਲਿਖਤਾਂ ਹੀ ਬਹੁਤ ਅੱਛੀਆਂ ਨੇ